ਇਲਾਕੇ ਤੋਂ ਬਾਹਰ ਯਾਤਰਾ ਕਰਦੇ ਸਮੇਂ ਵਿਤਕਰੇ ਜਾਂ ਪੱਖਪਾਤ ਦਾ ਅਨੁਭਵ ਮੈਂ ਕਦੇ ਨਹੀਂ ਕੀਤਾ ਵੈਸੇ ਤਾਂ ਮੈਂ ਘੁੰਮਣ ਫਿਰਨ ਦਾ ਬਹੁਤ ਸ਼ੌਕੀਨ ਹਾਂ ਅਤੇ ਮੈਂ ਘੁੰਮਦਾ ਫਿਰਦਾ ਰਹਿੰਦਾ ਹਾਂ ਥੋੜ੍ਹੇ ਸਮੇਂ ਪਹਿਲਾਂ ਅਸੀਂ ਹਿਮਾਚਲ ਵਿੱਚ ਘੁੰਮਣ ਗਏ ਤੇ ਅਤੇ ਜਿਸ ਕਾਰ ਘੁੰਮਣ ਗਏ ਤੇ ਜਦੋਂ ਅਸੀਂ ਉੱਥੇ ਗਏ ਤਾਂ ਉੱਥੇ ਦੇ ਲੋਕਾਂ ਨੇ ਸਾਨੂੰ ਬਹੁਤ ਸਤਿਕਾਰ ਦਿੱਤਾ ਜਦੋਂ ਅਸੀਂ ਘੁੰਮਦੇ ਗਏ ਤਾਂ ਅਸੀਂ ਪੱਗਾਂ ਬੰਨ੍ਹੀਆਂ ਪਈਆਂ ਤੀਆ ਸਾਨੂੰ ਹਰੇਕ ਹਰ ਕੋਈ ਸਰਦਾਰ ਜੀ ਸਰਦਾਰ ਜੀ ਕਹਿਕੇ ਬੁਲਾਉਂਦਾ ਹੈ ਅਤੇ ਉੱਥੇ ਦੇ ਜੋ ਉਹਨਾਂ ਦਾ ਨੇਚਰ ਆ ਉਹਨਾਂ ਦੀ ਅਸੀਂ ਘੁੰਮਦੇ ਫਿਰਦੇ ਉਹ ਸਾਨੂੰ ਆਪ ਹੁਣ ਆਪਣੇ ਨੇਚਰ ਬਾਰੇ ਦੱਸਦੇ ਆ ਕਿ ਹਾਂ ਕਿ ਇੱਥੇ ਆਹ ਕੁਛ ਹੋਇਆ ਇੱਥੇ ਮੰਦਰ ਇੱਥੇ ਹਿਮਾਚਲ ਵਿੱਚ ਬਹੁਤ ਵਧੀਆ ਮੰਦਰ ਆ ਅਤੇ ਅੱਜ ਵੀ ਅਸੀਂ ਜਾਂਦੇ ਹਾਂ ਉਹ ਸਾਡਾ ਬੜਾ ਸਤਿਕਾਰ ਕਰਦੇ ਆ ਵੈਸੇ ਅੱਜ ਤੱਕ ਮੈਂ ਕਿਸੇ ਵੀ ਇਹੋ ਜਿਹੇ ਪੱਥ ਪੱਖਪਾਤ ਦਾ ਅਨੁਭਵ ਨਹੀਂ ਕੀਤਾ ਕਿ ਜਦ ਵੀ ਅਸੀਂ ਜਾਂਦੇ ਹਾਂ ਤਾਂ ਉਸ ਨਾਲ਼ ਉਲਟਾ ਉਨ੍ਹਾਂ ਨੂੰ ਅਸਰ ਉਨ੍ਹਾਂ ਦੀ ਜ਼ਿੰਦਗੀ 'ਤੇ ਪ੍ਰਭਾਵ ਪੈਂਦਾ ਹੈ ਕਿ ਉਨ੍ਹਾਂ ਦਾ ਰੁਜ਼ਗਾਰ ਵੱਧਦਾ ਹੈ ਉਨ੍ਹਾਂ ਦਾ ਸਮਾਨ ਵਿੱਚ ਵਿਕਰੀ ਹੁੰਦੀ ਆ ਸ਼ੋਪਿੰਗ ਕਰਦੇ ਹਾਂ ਤਾਂ ਉਨ੍ਹਾਂ ਦੀ ਦੁਕਾਨਾਂ ਵਗੈਰਾ ਚੱਲਦੀਆਂ ਹਨ